ਹਾਂਜੀ ਬਿਜਲੀ ਦਾ ਤਾਂ ਸਾਡੀ ਜ਼ਿੰਦਗੀ 'ਤੇ ਬਹੁਤ ਜ਼ਿਆਦਾ ਵੱਡਾ ਰੋਲ ਹੈ ਬਿਜਲੀ ਦੇ ਬਗੈਰ ਕੋਈ ਵੀ ਕੰਮ ਕਰਨਾ ਅੱਜ ਕੱਲ੍ਹ ਔਖਾ ਹੈ ਅੱਜ ਕੁਛ ਟਾਈਮ ਲਈ ਬਿਜਲੀ ਜਾਂਦੀ ਅਤੇ ਇਸ ਤਰ੍ਹਾਂ ਬਿਲਕੁਲ ਘਰ ਵਿੱਚ ਜਿਸ ਤਰ੍ਹਾਂ ਕਹਿੰਦੇ ਕਿ ਰੌਣਕ ਹੀ ਖਤਮ ਹੋ ਗਈ ਰੌਣਕ ਵੀ ਨਾਲ ਹੀ ਇਹਦੇ ਜੁੜੀ ਹੋਈ ਹੈ ਬਾਕੀ ਕੋਈ ਵੀ ਕੰਮ ਕਰਨਾ ਅੱਜ ਕੱਲ੍ਹ ਬਿਜਲੀ 'ਤੇ ਜ਼ਿਆਦਾਤਰ ਹੈ ਜੇ ਮੰਨ ਲਉ ਅਸੀਂ ਘਰ 'ਚ ਕੋਈ ਅੱਜ ਕੱਲ੍ਹ ਫਰਿੱਜ ਵੀ ਹੈ ਬਿਜਲੀ ਨਾਲ ਚੱਲਣਾ ਕਿਉਂਕਿ ਗਰਮੀਆਂ ਨੂੰ ਇਹ ਤਾਂ ਸਾਡੀਆਂ ਰੋ ਸਬਜ਼ੀਆਂ ਸੁਬਜ਼ੀਆਂ ਵਗੈਰਾ ਖਰਾਬ ਹੋ ਜਾਂਦੀ ਹੈ ਅੱਜ ਕੱਲ੍ਹ ਇੰਡਕਸ਼ਨ ਚਲਦੇ ਆ ਹੀਟਰ ਹੈ ਮਤਲਬ ਕਿ ਲੋਕਾਂ ਨੇ ਮਤਲਬ ਕਿ ਇੰਡਕਸ਼ਨ ਦੇ ਉੱਤੇ ਖਾਣਾ ਵਗੈਰਾ ਬਣਾਉਂਦੇ ਆ ਓ ਟੀ ਜੀ ਹੈ ਮਾਈਕਰੋਵੇਵ ਹੈ ਇਹ ਸਾਰੀਆਂ ਚੀਜ਼ਾਂ ਬਿਜਲੀ ਨਾਲ ਹੀ ਚੱਲਦੀਆਂ ਅਤੇ ਜੇ ਬਿਜਲੀ ਮੰਨ ਲਉ ਕਿ ਬਿਜਲੀ ਬਿਜਲੀ ਦਾ ਮੰਨ ਲਉ ਜੇ ਕ ਕੱਟ ਲੱਗਦਾ ਤਾਂ ਤਾਂ ਕਾਫੀ ਮੁਸ਼ਕਿਲ ਆਉਂਦੀ ਉਸ ਟਾਈਮ ਦਿਨ ਵੇਲਾ ਤਾਂ ਟਾਈਮ ਨਿਕਲ ਜਾਂਦਾ ਰੌਸ਼ਨੀ ਵਿੱਚ ਰਾਤ ਵੇਲੇ ਬਹੁਤ ਜ਼ਿਆਦਾ ਮੁਸ਼ਕਿਲ ਆਉਂਦੀ ਹੈ ਅਤੇ ਇਹਦੇ ਵਿ ਇਹਦੇ ਵਿਕਲਪ ਇਸ ਤਰ੍ਹਾਂ ਮੰਨ ਲਉ ਕਿ ਟੌਰਚ ਹੈ ਜਾਂ ਮੋਬਾਈਲ 'ਤੇ ਮੋਬਾਈਲ ਦੇ ਨਾਲ ਅਸੀਂ ਇਸਨੂੰ ਟੋਰਚ ਵਿੱਚ ਜਾ ਸਕਦੇ ਹਾਂ ਹੁਣ ਦੇਖੋ ਨਾ ਕਈਆਂ ਲੋਕਾਂ ਕੋਲ ਤਾਂ ਇਨਵਰਟਰ ਹੈਗੇ ਆ ਸਾਰਿਆਂ ਕੋਲ ਤਾਂ ਇਨਵਰਟਰ ਹੈਗੇ ਨਹੀਂ ਆ ਅਤੇ ਜਿ ਜਿਹੜੇ ਨਹੀਂ ਅਫੋਡ ਕਰ ਸਕਦੇ ਉਹਨਾਂ ਤੋਂ ਹੋਰ ਵੀ ਜ਼ਿਆਦਾ ਮੁਸ਼ਕਿਲ ਆਉਂਦੀ ਆ ਜਿਹਨਾਂ ਕੋਲ ਇਨਵਰਟਰ ਆ ਉਹ ਤਾਂ ਕੁਛ ਟਾਈਮ ਆਪਣਾ ਕਰ ਵੀ ਲੈਂਦੇ ਹਾਂ ਕਈ ਕਈ ਇਸ ਤਰ੍ਹਾਂ ਦੇ ਵੀ ਆ ਕਿ ਜਿਹਨਾਂ ਦੇ ਕੋਲ ਸੋਲਰ ਸਿਸਟਮ ਵੀ ਹੈਗੇ ਆ ਹੋਰ ਸਭ ਕੁਛ ਆਪਣਾ ਇ ਅਰੇਂਜ ਕਰ ਲੈਂਦੇ ਆ ਬਿਜਲੀ ਦਾ ਬਾਕੀ ਦੇ ਬਿਜਲੀ ਨਹੀਂ ਹੋਏਗੀ ਮੰਨ ਲਉ ਗਰਮੀਆਂ ਨੂੰ ਏਸੀ ਵੀ ਬਿਜਲੀ ਉਹਦੇ ਬਿਜਲੀ ਬਗੈਰ ਨਹੀਂ ਚੱਲਣਾ ਅਤੇ ਸਵੇਰ ਦੇ ਥੱਕੇ ਜਿਸ ਤਰ੍ਹਾਂ ਹਰ ਥੱਕੇ ਹੋਏ ਲੋਕਾਂ ਨੇ ਰਾਤੀ ਨੀਂਦ ਪੂਰੀ ਨਹੀਂ ਕਰ ਸ ਸਕਣਗੇ ਏਸੀ ਤੋਂ ਬਗੈਰ ਅਤੇ ਸਵੇਰੇ ਉਹਨਾਂ ਨੇ ਕੰਮ 'ਤੇ ਜਾਣਾ ਮੁਸ਼ਕਿਲ ਹੋ ਜਾਂਦਾ ਇਸ ਤਰ੍ਹਾਂ ਬਿਜਲੀ ਦਾ ਸਾਡੇ ਜ਼ਿੰਦ ਜਿੰਦਗੀ ਵਿੱਚ ਬਹੁਤ ਹੀ ਵੱਡਾ ਰੋਲ ਹੈ